ਡਾਂਸ ਦਰਸ਼ਕਾਂ ਵਿੱਚ ਭਾਵਨਾ ਪੈਦਾ ਕਰਨ ਦੀ ਸ਼ਕਤੀ ਰੱਖਦਾ ਹੈ ਕਿਉਂਕਿ ਡਾਂਸ ਇੱਕ ਅਜਿਹਾ ਰੂਪ ਹੈ ਜਿਹੜਾ ਗੀਤ ਨੂੰ ਹੋਰ ਨਿਖਾਰਦਾ ਹੈ ਅਤੇ ਗੀਤ ਦੇ ਵਿੱਚ ਜੋ ਵੀ ਚੱਲ ਚੱਲ ਰਿਹਾ ਹੁੰਦਾ ਜਾਂ ਜੋ ਵੀ ਕੋਈ ਗਾ ਰਿਹਾ ਹੈ ਉਸ ਨੂੰ ਫੀਜ਼ੀਕਲੀ ਪੇ ਪੇਸ਼ ਕਰਦਾ ਹੈ ਜਿਸ ਨਾਲ ਲੋਕ ਕੀ ਹੈ ਗੀਤ ਦੇ ਨਾਲ ਨਾਲ ਡਾਂਸ ਨਾਲ ਵੀ ਜੁੜ ਜਾਂਦੇ ਹਨ ਡਾਂਸ ਰਾਹੀਂ ਆਪਾਂ ਆਪਣੇ ਅਲੱਗ ਅਲੱਗ ਭਾਵਨਾ ਜਿਵੇਂ ਖੁਸ਼ੀ ਦੁੱਖ ਗੁੱਸਾ ਸਾਰਾ ਪ੍ਰਗਟਾ ਸਕਦੇ ਹਾਂ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜ ਸਕਦੇ ਹਾਂ ਡਾਂਸ ਰਾਹੀਂ ਆਪਾਂ ਕੋਈ ਵੀ ਸੰਦੇਸ਼ ਵੀ ਪਹੁੰਚਾ ਸਕਦੇ ਹਨ ਜਿਵੇਂ ਕਿ ਕੋਈ ਸੱਭਿਆਚਾਰਕ ਲੋਕ ਗੀਤ ਰਾਹੀਂ ਆਪਾਂ ਜੇਕਰ ਡਾਂਸ ਵਿੱਚ ਪੇਸ਼ ਕਰੀਏ ਤਾਂ ਲੋਕ ਸੱਭਿਆਚਾਰ ਵੱਲ ਨੂੰ ਹੋਰ ਜੁੜ ਜਾਂਦੇ ਨੇ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਸੱਭਿਆਚਾਰ ਵੱਲ ਹੋਰ ਵੱਧ ਜਾਂਦੀਆਂ ਹਨ ਜਿਵੇਂ ਕਿ ਵਿਸਾਖੀ ਦੇ ਮੌਕੇ ਵਿੱਚ ਕਿਸਾਨ ਹੈ ਜੋ ਕਿ ਆਪਣੀ ਖੁਸ਼ੀ ਨੂੰ ਭੰਗੜਾ ਪਾ ਕੇ ਜ਼ਾਹਰ ਕਰਦਾ ਹੈ ਉਹ ਨੱਚ ਕੇ ਦੱਸਦਾ ਹੈ ਕਿ ਉਹ ਕਿੰਨਾ ਖੁਸ਼ ਹੈ ਵਿਸਾਖੀ ਦੇ ਮੌਕੇ ਉਸ ਦੀ ਫਸਲ ਪੱਕੀ ਹੈ ਅਤੇ ਉਸ ਨੂੰ ਵਾਢੀ ਕਰਨ ਲਈ ਉਹ ਤਿਆਰ ਹੈ ਜਿਹੜੀ ਵੀ ਖੁਸ਼ੀ ਹੈ ਉਹ ਆਪਣੇ ਡਾ ਪੂਰੇ ਹੀ ਭੰਗੜੇ ਵਿੱਚ ਜੀ ਜਾਨ ਲਾ ਕੇ ਉਸ ਨੂੰ ਜ਼ਾਹਰ ਕਰਦਾ ਹੈ ਇਸ ਤਰ੍ਹਾਂ ਲੋਕ ਡਾਂਸ ਨਾਲ ਹੋਰ ਜ਼ਿਆਦਾ ਆਪਣੀਆਂ ਭਾਵਨਾਵਾਂ ਨੂੰ ਜੋੜ ਕੇ ਇੱਕ ਦੂਜੇ ਨਾਲ ਆਪਣੀਆਂ ਜਿਹੜੀਆਂ ਵੀ ਭਾਵਨਾਵਾਂ ਉਹ ਸ਼ੇਅਰ ਕਰਦੇ ਹਨ ਜੇਕਰ ਕੋਈ ਬੰਦਾ ਵਧੀਆ ਡਾਂਸ ਕਰ ਰਿਹਾ ਹੋਵੇ ਤਾਂ ਦੂਸਰੇ ਦਾ ਮਨ ਵੀ ਆਪਣੇ ਆਪ ਹੀ ਉਸ ਵੱਲ ਆਕਰਸ਼ਿਤ ਹੋ ਜਾਂਦਾ ਹੈ ਅਤੇ ਉਸ ਨਾਲ ਡਾਂਸ ਕਰਨ ਦੀ ਭਾਵਨਾਵਾਂ ਉਸ ਵਿੱਚ ਪੈਦਾ ਹੋਣ ਲੱਗ ਜਾਂਦੀ ਹੈ ਇਸ ਤਰ੍ਹਾਂ ਡਾਂਸ ਅਲੱਗ ਅਲੱਗ ਭਾਵਨਾਵਾਂ ਨੂੰ ਦਰਸਾਉਂਦਾ ਹੈ ਅਤੇ ਲੋਕਾਂ ਦੀਆਂ ਫੀਲਿੰਗਾਂ ਨੂੰ ਦੱਸਦਾ ਹੈ